ਲੰਬੀ ਯਾਤਰਾ ਵਿੱਚ ਤੁਹਾਡੇ ਲਈ ਸਭ ਤੋਂ ਫਸ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਚਿਪਸ ਹੋ ਗਏ ਨਮ ਕੁਝ ਨਮਕੀਨ ਹੋ ਗਿਆ ਇਹ ਸਭ ਕੁਝ ਪਾਣੀ ਹੋ ਗਿਆ ਇਹ ਨਾਲ ਲੈ ਕੇ ਜਾਓ ਜੇ ਤਾਂ ਤੁਸੀਂ ਤਿੰਨ ਚਾਰ ਦਿਨ ਦੀ ਯਾਤਰਾ 'ਤੇ ਲੈ ਕੇ ਜਾ ਰਹੇ ਹੋ ਜੇ ਤੁਹਾਡੇ ਨਾਲ ਆਪਣੀ ਫੈਮਲੀ ਆ ਬੱਚੇ ਵੀ ਆ ਬੱਚਿਆਂ ਲਈ ਦੁੱਧ ਹੋ ਗਿਆ ਫਿਰ ਕੁਝ ਕੱਪੜੇ ਐ ਸਭ ਕੁਛ ਮਤਲਬ ਨਾਲ ਲੈ ਕੇ ਜਾਣਾ ਪੈਂਦਾ ਹੈ ਅਤੇ ਵ ਕਿਉਂਕਿ ਤੁਸੀਂ ਢਾਬੇ 'ਤੇ ਵਾਰ ਵਾਰ ਰੁਕ ਕੇ ਰੋਟੀ ਵੀ ਖਾ ਸਕਦੇ ਹੋ ਪਰ ਰਸਤੇ 'ਚ ਜਾਂਦਿਆਂ ਜੇ ਤੁਹਾਨੂੰ ਭੁੱਖ ਲੱਗ ਜਾਵੇ ਅਤੇ ਤੁਸੀਂ ਫਿਰ ਕੁਝ ਆਪਣੇ ਬੈਗ 'ਚੋਂ ਕੱਢ ਕੇ ਕੁਝ ਖਾ ਸਕਦੇ ਹੋ ਅਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕੁਝ ਨਾ ਕੁਝ ਆਪਣੇ ਨਾਲ ਲੈ ਕੇ ਜਾਓ ਸਭ ਤੋਂ ਵਧੀਆ ਕਿ ਤੁਸੀਂ ਆਪਣੇ ਨਾਲ ਭੁੱਜੇ ਚਨੇ ਲੈ ਕੇ ਜਾਓ ਛੋਲੇ ਜਿਹਨੂੰ ਕਹਿੰਦੇ ਆ ਛੋਲੇ ਲੈ ਕੇ ਜਾਓ ਉਹ ਸਭ ਤੋਂ ਸਸਤਾ ਅਤੇ ਸਭ ਤੋਂ ਟਿਕਾਊ ਤਰੀਕਾ ਜੀ ਜੇ ਉਹ ਤੁਸੀਂ ਲੈ ਕੇ ਜਾਂਦੇ ਹੋ ਤਾਂ ਉਹਦੇ ਨਾਲ ਬੰਦੇਦਾਰ ਬੰਦੇ ਦਾ ਢਿੱਡ ਵੀ ਭਰਿਆ ਰਹਿੰਦਾ ਹੈ ਅਤੇ ਬੰਦੇ ਨੂੰ ਵਾਰ ਵਾਰ ਭੁੱਖ ਵੀ ਨਹੀਂ ਲੱਗਦੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਓ ਕਿਉਂਕਿ ਜਦੋਂ ਤੁਸੀਂ ਚਨੇ ਖਾਂਦੇ ਹੋ ਤਾਂ ਤੁਹਾਨੂੰ ਪਿਆਸ ਬਹੁਤ ਲੱਗਦੀ ਹੈ ਠੀਕ ਹੈ ਜੀ ਅਤੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਓ ਕਿਉਂਕਿ ਪਾਣੀ ਦੀ ਬਹੁਤ ਹੀ ਅ ਜ਼ਰੂਰਤ ਹੁੰਦੀ ਹੈ ਹਾਂਜੀ ਪਾਣੀ ਬਹੁਤ ਹੀ ਆ ਇੱਕ ਜ਼ਰੂਰੀ ਚੀਜ਼ ਹੈ ਨਾਲ ਗਲੋਕੋਜ਼ ਲੈ ਕੇ ਜਾਓ ਫਿਰ ਆਪਣਾ ਰਸਨਾ ਲੈ ਕੇ ਜਾਓ ਇਹ ਸਭ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੀ